ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਬਲਜੀਤ ਸਿੰਘ ਬੋਲਦਾ ਜੀ ਕਨੇਡਾ ਤੋਂ ਹਾਂ ਜੀ ਮੈਂ ਤੇ ਮੇਰਾ ਯੂਟਿਊਬ ਚੈਨਲ ਆ ਜੀ ਅਤੇ ਮੈਂ ਫਤਿਹਗੜ੍ਹ ਬਾਰੇ ਕਾਫੀ ਕੁਝ ਦੇਖਿਆ ਚੈਨਲ 'ਤੇ ਆਪਣੇ 'ਤੇ ਅਤੇ ਮੈਂ ਇਹਦੇ ਬਾਰੇ ਫਤਿਹਗੜ੍ਹ ਆ ਕੇ ਜੀ ਇਸ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜੀ ਮੈਂ ਜੀ ਜੀ ਜੀ ਠੀਕ ਹੈ

ਜੀ ਜੀ ਅਤੇ ਮੈਂ ਆਪਣੇ ਯੂਟਿਊਬ ਜੀ ਮੈਂ ਆਪਣੇ ਜੀ ਜੀ ਠੀਕ ਹੈ ਸਰ ਜੀ ਅਤੇ ਆਪ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ